ਹਾਂਜੀ ਮੈਨੂੰ ਲੱਗਦਾ ਹੈ ਕਿ ਹੋਰ ਗ੍ਰਹਿ 'ਤੇ ਵੀ ਜੀਵਨ ਹੈਗਾ ਜਿਵੇਂ ਸਾਡੇ ਵਰਲਡ 'ਚੋਂ ਜਿਵੇਂ ਅਮਰੀਕਾ ਦਾ ਇੱਕ ਜਹਾਜ਼ ਮਾਰਸ 'ਤੇ ਗਿਆ ਸੀ ਉਹਨਾਂ ਨੇ ਉੱਥੇ ਜਾ ਕੇ ਰੀਸਰਚ ਕੀਤੀ ਅਤੇ ਪਤਾ ਲੱਗਿਆ ਕਿ ਉਹਦਾ ਜਿਹੜਾ ਵਾਤਾਵਰਨ ਹੈ ਉਹ ਆਪਣੀ ਧਰਤੀ ਨਾਲ਼ ਬਹੁਤ ਮਿਲਦਾ ਜੁਲਦਾ ਨਾਲ਼ੇ ਆਪਾਂ ਜਿਵੇਂ ਪੜ੍ਹਦੇ ਹਾਂ ਸਾਇੰਸ 'ਚ ਕਿ ਆਪਾਂ ਬੜੀ ਮਿਲਕੀ ਵੇ ਗਲੈਕਸੀ ਬਹੁਤ ਵੱਡੀ ਹੈ ਅਤੇ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਹੀ ਗਲੈਕਸੀਆਂ ਨੇ ਅਤੇ ਹਰ ਗਲੈਕਸੀ 'ਚ ਪਤਾ ਨਹੀਂ ਕਿੰਨੇ ਹੀ ਪਲੈਨਿਟ ਨੇ ਅਤੇ ਮੈਨੂੰ ਲੱਗਦਾ ਹੈ ਕਿ ਹਾਲੇ ਅਸੀਂ ਓਨੀ ਰੀਸਰਚ ਨਹੀਂ ਕੀਤੀ ਕਿ ਸਾਨੂੰ ਪਤਾ ਲੱਗ ਸਕੇ ਪਰ ਮੇਰਾ ਮੰਨਣਾ ਹੈ ਕਿ ਹੋਣਗੇ ਹੋਰ ਗ੍ਰਹਿ 'ਤੇ ਵੀ ਜੀਵਨ ਹੈਗਾ ਕਿਉਂਕਿ ਕਈ ਵਾਰੀ ਖ਼ਬਰ ਵੀ ਆਉਂਦੀ ਹੈ ਕਿ ਇੱਕ ਯੂ ਐੱਫ ਓ ਜਿਹੜਾ ਦਿਖਿਆ ਜਾਂ ਫੜਿਆ ਗਿਆ ਫਿਰ ਉਹ ਕਿੱਥੋਂ ਤਾਂ ਆਉਂਦੇ ਹੀ ਹੋਣੇ ਤਾਂ ਮੈਨੂੰ ਲੱਗਦਾ ਜੇ ਜਿੰਨੇ ਵੀ ਆਰਟੀਕਲ ਨੇ ਜਿਵੇਂ ਨਾਸਾ ਇਹਦੇ 'ਤੇ ਬਹੁਤ ਰੀਸਰਚ ਕਰਦਾ ਰਹਿੰਦਾ ਉਹ ਲੱਭਦੇ ਰਹਿੰਦੇ ਨੇ ਕਿ ਕਿਹੜੇ ਗ੍ਰਹਿ 'ਤੇ ਪਾਣੀ ਆ ਹੁਣ ਜੇ ਜਿਸ ਗ੍ਰਹਿ 'ਤੇ ਪਾਣੀ ਹੋਊਗਾ ਤਾਂ ਕਹਿੰਦੇ ਕਿ ਜੀਵਨ ਤਾਂ ਹੋਊਗਾ ਹੀ ਤਾਂ ਮਨ ਮੇਰਾ ਮੰਨਣਾ ਹੈਗਾ ਕਿ ਹੋਰ ਗ੍ਰਹਿਆਂ 'ਤੇ ਵੀ ਜੀਵਨ ਹੈ